ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਠੀਕ ਐ ਜੀ ਠੀਕ ਐ ਠੀਕ ਐ ਜੀ

ਦੇਖੋ ਜਦੋਂ ਤੁਸੀਂ ਪੁਰਾਣੀ ਕਿਸੇ ਵੀ ਇਮਾਰਤ ਨੂੰ ਲੋਕ ਕਰਨਾ ਹੁੰਦਾ ਪਹਿਲਾਂ ਤਾਂ ਤੁਸੀਂ ਮੈਨੂੰ ਆਪਣਾ ਬਜਟ ਦੱਸੋ ਤੁਹਾਡਾ ਬਜਟ ਕੀ ਐ ਜੇ ਤੁਹਾਡੀਆਂ ਜਿਵੇਂ ਵੋਲ ਕਰੈਕਸ ਨਹੀਂ ਆ ਜਸਟ ਸੀਲਨ ਆ ਜਾਂ ਕੋਈ ਪੇਂਟਿੰਗ ਦੀ ਪ੍ਰੋਬਲਮ ਹੈਗੀ ਐ ਫਿਰ ਸਾਡੇ ਕੋਲ ਸਲਊਸ਼ਨ ਐ ਜੀ ਤਿੰਨ ਤਿੰਨ ਤਰ੍ਹਾਂ ਦੇ ਸਲਊਸ਼ਨ ਸਾਡੇ ਕੋਲ ਹੈਗੇ ਆ ਜਾਂ ਤਾਂ ਤੁਸੀਂ ਉਹਨੂੰ ਮੋਡੀਫਾਈ ਟੈਕਸਚਰ ਪੇਂਟ ਦੀ ਕੋਡਿੰਗ ਕਰਵਾ ਸਕਦੇ ਓ ਵੋਲਸ ਤੇ ਉਹਦੇ ਨਾਲ ਇੱਕ ਬਹੁਤ ਅੱਛੀ ਲੁੱਕ ਆਉਂਦੀ ਆ ਤੇ ਥੋੜਾ ਵੋਲਜ਼ ਵੀ ਸਟਰੋਂਗ ਹੋ ਜਾਂਦੀਆਂ ਦੂਜਾ ਤੁਸੀਂ ਪੀਵੀਸੀ ਸ਼ੀਟਸ ਵੀ ਲੈ ਸਕਦੇ ਓ ਤੀਸਰਾ ਤੁਹਾਡੇ ਕੋਲ ਜਿਹੜੀ ਵੋਲ ਪੇਪਰ ਡੈਕੋਰੇਸ਼ਨ ਆਉਂਦੀ ਅੱਜ ਕੱਲ ਉਹ ਡਿਜੀਟਲ ਤੇ ਸਾਡੇ ਕੋਲੇ ਬਿਲਕੁਲ ਬਹੁਤ ਸੋਹਣੀ ਤਰ੍ਹਾਂ ਦੀਆਂ ਡਿਜ਼ਾਇਨਿੰਗਸ ਹੈਗੀਆਂ ਜਿੱਦਾਂ ਦੇ ਤੁਸੀਂ ਕਲਰ ਕਹੋਗੇ ਵਾਈਬਰੈਂਟ ਕਲਰ ਹਨਾ ਲਾਈਟ ਕਲਰ ਇੰਗਲਿਸ਼ ਕਲਰ ਉਹ ਸਾਰੀਆਂ ਚੀਜਾਂ ਡਿਜੀਟਲ ਪ੍ਰਿੰਟ ਦੇ ਵਿੱਚ ਸਾਡੇ ਕੋਲ ਐਵੇਲੇਬਲ ਨੇ ਪਲੇਨ ਵੀ ਸਾਡੇ ਕੋਲ ਬਹੁਤ ਜਿਵੇਂ ਐਨਟੀਕ ਐ ਵੂਡਨ ਸਟਾਈਲਿਸ਼ ਸਾਡੇ ਕੋਲ ਸਰਵੈਂਟ ਰੀਲ ਪਿਆ ਸੀ ਉਹ ਅਸੀਂ ਉਹਦੇ ਅਕੋਰਡਿੰਗ ਹੀ ਕਰਦੇ ਆਂ ਕੀ ਤੁਹਾਡਾ ਜਿੰਨਾ ਕ ਬਜਟ ਤੁਸੀਂ ਕਿੰਨਾ ਘੱਟ ਤੋਂ ਘੱਟ ਬਜਟ ਸੋਚਿਆ ਹੋਇਆ ਉਹਦੇ ਅਕੋਰਡਿੰਗ ਫਿਰ ਅਸੀਂ ਤੁਹਾਨੂੰ ਸੁਜਸਟ ਕਰਾਂਗੇ ਤੁਸੀਂ ਇਹ ਚੀਜ਼ ਲਗਵਾਲੋ ਅੱਛਿਆ ਜੀ ਤੇ ਸਰ ਤੁਸੀਂ ਫਿਰ ਉਹਦੇ ਵਿੱਚ ਤੁਸੀਂ ਪੀਵੀਸੀ ਸ਼ੀਟਸ ਦੀ ਜਾਲੀ ਸਾਰੀ ਹੈਗੀ ਆ ਵੋਲ ਦੀ ਸਿਲਿੰਗ ਕਰਾਓ ਉਪਰ ਡਾਊਨ ਸਿਲਿੰਗ ਵੀ ਸਾਰੀ ਜੇ ਤੁਹਾਡੀ ਨਹੀਂ ਹੋਈ ਕਿਉਂਕੀ ਉਮੀਦ ਐ ਕਿਉਂਕੀ ਵੀਹ ਸਾਲ ਪਹਿਲਾਂ ਤਾਂ ਡਾਊਨ ਸਿਲਿੰਗ ਦਾ ਇਨਾ ਕੋਈ ਫੈਸ਼ਨ ਵੀ ਨੀ ਸੀ ਤੇ ਉਹਦੇ ਵਿੱਚ ਤੁਸੀਂ ਸਾਰੀ ਲਾਈਟਿੰਗ ਵਗੈਰਾ ਵੀ ਕਰਾ ਲੋਗੇ ਤਾਂ ਬੜੀ ਆਰਾਮ ਨਾਲ ਤੇ ਫਲੋਰਿੰਗ ਵੀ ਤੁਹਾਡੀ ਇਹਦੇ ਵਿੱਚ ਕਵਰ ਹੋਜੇਗੀ ਤੇ ਤੁਸੀਂ ਦੱਸੋ ਵੀ ਤੁਸੀਂ ਕਦੋਂ ਤੋਂ ਕੰਮ ਸ਼ੁਰੂ ਕਰਾਉਣਾ ਚਾਹੁਨੇ ਆ ਤੇ ਮੈਂ ਮੇਰਾ ਜਿਹੜਾ ਇੱਕ ਅਸਿਸਟੈਂਟ ਹੈਗਾ ਨਾ ਵਿਜਿਟ ਕਰੇਗਾ ਤੇ ਉਹ ਵਿਜਿਟ ਕਰਕੇ ਉਹ ਏਰੀਆ ਤੇ ਸਾਰਾ ਕੁਛ ਅਸੀਂ ਰੂਮ ਦੇ ਸਾਈਜ਼ ਕੱਢ ਕੇ ਤੁਹਾਨੂੰ ਉਹਦੇ ਅਕੋਰਡਿੰਗ ਸਾਰਾ ਦੱਸ ਦਿਆਂਗੇ ਇਹ ਵੀ ਦੱਸ ਦਿਆਂਗੇ ਕੀ ਇਨਾ ਟਾਈਮ ਲੱਗੇਗਾ ਉਹਦੇ ਅਕੋਰਡਿੰਗ ਆਪਾਂ ਸੈਟਿੰਗ ਕਰ ਸਕਦੇ ਆਂ ਤੇ ਤੁਸੀਂ ਜਿਹੜੀ ਸਾਡੀ ਪਹਿਲੀ ਫਸਟ ਵਿਜਿਟ ਐ ਨਾ ਉਹ ਜਸਟ ਫਾਈਵ ਹੰਡਰਡ ਨਾਲ ਸ਼ੁਰੂ ਹੁੰਦੀ ਐ ਜਿਹਦੇ ਵਿੱਚ ਦੇਖੋ ਚਾਹੇ ਉਹ ਜਿਹੜੇ ਹੈਗੇ ਐ ਕਈ ਵਾਰੀ ਵੀ ਹੁੰਦਾ ਲੋਕੀ ਕੈਂਸਲ ਕਰ ਦਿੰਦੇ ਸਾਡਾ ਰੇਟ ਦੇਖ ਕੇ ਜਾਂ ਕੁਛ ਵੀ ਕਹਿ ਲਓ ਤਾਂ ਫਿਰ ਇਸ ਤਰ੍ਹਾਂ ਤਾਂ ਸਾਡਾ ਜਿਹੜਾ ਅਸਿਸਟੈਂਟ ਉਹ ਤਾਂ ਚੱਕਰ ਈ ਮਾਰੀ ਜਾਏਗਾ ਤਾਂ ਸਾਡੀ ਪਹਿਲੀ ਵਿਜਿਟ ਫਾਈਵ ਹੰਡਰਡ ਦੀ ਹੁੰਦੀ ਐ ਜੇ ਉਹ ਸਾਨੂੰ ਪਾਰਟੀ ਓਕੇ ਕਰ ਦਿੰਦੀ ਐ ਉਸ ਤੋਂ ਬਾਅਦ ਕੋਈ ਚਾਰਜਿਸ ਨੀ ਫੇਰ ਸਾਡੇ ਚਾਰਜਿਸ ਜਿਹੜੇ ਹੈਗੇ ਐ ਫਾਈਨਲ ਬਿੱਲ ਦੇ ਨਾਲ ਈ ਇੰਕਲੂਡ ਹੋ ਕੇ ਆਣਗੇ ਉਹ ਸਾਡੀ ਮਿਨੀਮਮ ਫੀਸ ਹੁੰਦੀ ਐ ਜੀ

ਹਾਂਜੀ ਠੀਕ ਐ ਜੀ ਠੀਕ ਐ ਜੀ ਤੁਸੀਂ ਮੈਨੂੰ ਫੋਨ ਕਰ ਦੇਣਾ ਤੇ ਮੈਂ ਆਪਣਾ ਅਸਿਸਟੈਂਟ ਸਾਡੇ ਘਰ ਭੇਜ ਦਵਾਂਗੀ ਮੈਂ ਵਟਸਐਪ ਤੇ ਐਡਰੈਸ ਕਰ ਦਿਓ ਤੁਸੀਂ ਕਦੋਂ ਐਵੇਲੇਬਲ ਓ ਠੀਕ ਐ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਧੰਨਵਾਦ